ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਫਿਲਹਾਲ ਤਾਂ ਅਪ੍ਰੈਲ ਮਈ ਤੱਕ ਬੱਚਿਆਂ ਦੇ ਲਾਸਟ ਸੈਮਸਟਰ ਵਾਲਿਆਂ ਦੇ ਪੇਪਰ ਹੋ ਜਾਣੇ ਆ ਉਸ ਤੋਂ ਬਾਅਦ ਫਿਰ ਮੇ ਬੀ ਸਤੰਬਰ ਤੱਕ ਬੱਚਿਆਂ ਦੀਆਂ ਐਡਮਿਸ਼ਨ ਸਟਾਰਟ ਹੋ ਜਾਂਦੀਆਂ ਮਤਲਬ ਯੂਨੀਵਰਸਿਟੀ ਪੋਰਟਲ ਖੁੱਲ੍ਹ ਜਾਂਦਾ ਆ ਉਹਦੇ ਵਿੱਚ ਨੋਟੀਫਿਕੇਸ਼ਨ ਆ ਜਾਂਦੀ ਆ ਫਸਟ ਕੌਂਸਲਿੰਗ ਦੀ ਤੁਸੀਂ ਇੱਕ ਵਾਰੀ ਕੋਲੇਜ ਆਉਣਾ ਕੋਲੇਜ ਆਪਣੀ ਡੋਕੂਮੈਂਟ ਲੈ ਕੇ ਆਉਣਾ ਆਪਣਾ ਸਾਰਾ ਜੋ ਹੈ ਤੁਹਾਡਾ ਇੱਕ ਵਾਰੀ ਲਿਖਵਾ ਜਾਣਾ ਨੋਟ ਡਾਊਨ ਕਰਵਾ ਜਾਣਾ ਨਾਮ ਐਡਰੈੱਸ ਫੋਨ ਨੰਬਰ ਉਹਦੇ ਨਾਲ ਕੀ ਹੋਏਗਾ ਕਿ ਤੁਹਾਨੂੰ ਫਸਟ ਕੌਂਸਲਿੰਗ ਜਦੋਂ ਖੁੱਲੇਗੀ ਜਾਂ ਫਸਟ ਕੌਂਸਲਿੰਗ ਦੀਆਂ ਐਡਮਿਸ਼ਨ ਸਟਾਰਟ ਹੋਣੀ ਆ ਨਾ ਮੈਂ ਤੁਹਾਨੂੰ ਕੌਲ ਕਰ ਦਾਂਗੀ ਠੀਕ ਹੈ ਬਾਕੀ ਅਗਰ ਤੁਸੀਂ ਫੀਸ ਰਿਗਾਰਡਿੰਗ ਕੋਈ ਗੱਲ ਕਰਨੀ ਹੈ ਜਾਂ ਤੁਸੀਂ ਸਬਜੈਕਟ ਰਿਗਾਰਡਿੰਗ ਕੋਈ ਗੱਲ ਕਰਨੀ ਹੈ ਤਾਂ ਤੁਸੀਂ ਇੱਕ ਵਾਰੀ ਬੱਚੇ ਸਕੂਲ ਆ ਕੇ ਮੈਮ ਨੂੰ ਮਿਲ ਕੇ ਇੱਕ ਮੈਨੂੰ ਇਨਫੋਰਮੇਸ਼ਨ ਸਾਰੀ ਲਿਖਵਾ ਦੇਣਾ ਆਪਣੀ ਜੋ ਵੀ ਹੈ ਐਡਰੈੱਸ ਨੇਮ ਮੋਬਾਇਲ ਨੰਬਰ ਤਾਂ ਕਿ ਮੈਂ ਤੁਹਾਨੂੰ ਟਾਈਮ ਸਿਰ ਕੌਲ ਕਰਦਾਂ ਦੂਜੀ ਗੱਲ ਇਹ ਕਿ ਤੁਹਾਨੂੰ ਸਬਜੈਕਟ ਦੇ ਰਿਗਾਰਡਿੰਗ ਅਗਰ ਕੋਈ ਇਨਫੋਰਮੇਸ਼ਨ ਜਾਂ ਨੌਲੇਜ ਚਾਹੀਦੀ ਹੈ ਤਾਂ ਤੁਸੀਂ ਕੋਲੇਜ ਕੋਲੇਜ ਆ ਕੇ ਇੱਕ ਵਾਰੀ ਮੈਮ ਨਾਲ ਵਿਜਿਟ ਕਰ ਸਕਦੇ ਹੋ ਮੈਮ ਨਾਲ ਇਨ ਇਨਫੋ ਟ੍ਰਾਂ ਕਨਵਰਸੇਸ਼ਨ ਕਰ ਸਕਦੇ ਹੋ ਬਾਕੀ ਇਹ ਹੈ ਕਿ ਤੁਹਾਨੂੰ ਬਾਅਦ ਵਿੱਚ ਕੋਈ ਜਾ ਕੇ ਸਬਜੈਕਟ ਦੀ ਪ੍ਰੋਬਲਮ ਨਹੀਂ ਆਏਗੀ ਓਕੇ ਹਾਂਜੀ ਓਕੇ ਚਲ ਠੀਕ ਹੈ ਕੋਈ ਨਾ ਇੱਕ ਵਾਰੀ ਤੁਸੀਂ ਵਿਜ਼ਿਟ ਕਰਨਾ ਠੀਕ ਹੈ ਬਾਕੀ ਬਾਅਦ 'ਚ ਕਰ ਲਾਂਗੇ ਗੱਲ ਆਪਾਂ ਓਕੇ ਓਕੇ ਓਕੇ ਵੈਲਕਮ